ਬੁਣਾਈ ਨਾਲ ਸੰਬੰਧਿਤ ਬੁਣਾਈ ਨਾਲ ਸਬੰਧਿਤ ਬਹੁਤ ਕੁਛ ਹੈ ਮੈਨੂੰ ਬਹੁਤ ਸ਼ੌਂਕ ਹੈ ਸਿਲਾਈ ਕਰਨ ਦਾ ਨਿਟਿੰਗ ਮੈਂ ਆਪਣੇ ਗੁਆਂਢੀਆਂ ਤੋਂ ਸਿੱਖੀ ਸੀ ਆਂਟੀ ਬੁਣਦੇ ਹੁੰਦੇ ਸੀ ਸਾਡੇ ਨਾਲ ਦੇ ਤਾਂ ਮੈਨੂੰ ਸ਼ੌਂਕ ਸੀ ਪਹਿਲਾਂ ਮੈਂ ਡੱਕਿਆਂ 'ਤੇ ਜਿਵੇਂ ਪਹਿਲਾਂ ਸਟਾਰਟ ਕੀਤਾ ਬੁਣਨਾ ਹੌਲੀ ਹੌਲੀ ਜਿਵੇਂ ਮੈਨੂੰ ਸ਼ੌਂਕ ਚੜਿਆ ਵੀ ਵਧੀਆ ਲੱਗਿਆ ਬੁਣਨਾ ਤਾਂ ਫਿਰ ਮੈਂ ਹੋਰ ਬੁਣਨ ਲੱਗੀ ਜਿਵੇਂ ਪਹਿਲਾਂ ਮੈਂ ਸੋਕਸ ਸ਼ੁਰੂ ਕੀਤਾ ਬੁਣਨਾ ਹੌਲੀ ਹੌਲੀ ਮੈਂ ਫਿਰ ਕੋਟੀ ਵਗੈਰਾ ਬੁਣੀ ਮੇਰੇ ਬੱਚੇ ਹੈਗੇ ਹੈ ਮੈਂ ਉਨ੍ਹਾਂ ਦੇ ਵੀ ਆਪਣੀ ਹੱਥੀਂ ਬੁਣੇ ਹੈ ਜਿਵੇਂ ਕੋਟੀ ਵਗੈਰਾ ਜੁਰਾਬਾਂ ਵਗੈਰਾ ਟੋਪੀ ਵਗੈਰਾ ਸਾਰਾ ਕੁਛ ਬੁਣਿਆ ਮੈਨੂੰ ਇਹਨਾਂ ਦਾ ਨਿਟਿੰਗ ਕਰਨ ਦਾ ਬਹੁਤ ਸ਼ੌਂਕ ਹੈ ਮੈਂ ਬਹੁਤ ਸ਼ੌਂਕ ਨਾਲ ਕਰਦੀ ਹਾਂ ਅਤੇ ਮੈਂ ਕਈ ਵਾਰ ਯੂਟੂਬ 'ਤੋਂ ਵੇਖਦੀ ਹਾਂ ਯੂਟੂਬ 'ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੁੰਦੇ ਆ ਉਨ੍ਹਾਂ ਨੂੰ ਵੇਖ ਕੇ ਮੈਂ ਡਿਜ਼ਾਈਨ ਪਾਉਂਦੀ ਹਾਂ ਆਪਣੇ ਬੱਚਿਆਂ ਲਈ ਬਣਾਉਂਦੀ ਹਾਂ ਆਪਣੇ ਲਈ ਬਣਾਉਂਦੀ ਹਾਂ ਮੈਨੂੰ ਬਹੁਤ ਆਨੰਦ ਆਉਂਦਾ ਹੈ ਬਣਾਉਣ 'ਤੇ ਮੈਂ ਕਈ ਵਾਰ ਸ਼ੋਪ ਵਗੈਰਾ 'ਤੇ ਜਿਵੇਂ ਬੁਨਣੇ ਦਿੰਦੇ ਹੈ ਉਹ ਵੀ ਬਣਾ ਲੈਂਦੀ ਹਾਂ ਮੈਨੂੰ ਇੰਨਾ ਮਜ਼ਾ ਆਉਂਦਾ ਬੁਣਨ 'ਤੇ ਬੁਣਾਈ ਕਰਨ 'ਤੇ ਪੁੱਛੋ ਹੀ ਨਾ ਮੈਨੂੰ ਖੁਸ਼ੀ ਹੁੰਦੀ ਆ ਵੀ ਕੋਈ ਮੇਰੇ ਬੁਣੇ ਮੈਨੂੰ ਕੋਈ ਕਹੇ ਮੈਨੂੰ ਬਣਾ ਕੇ ਦੇ ਤਾਂ ਮੈਂ ਝੱਟ ਬਣਾ ਕੇ ਦੇ ਦਿੰਨੀ ਹਾਂ ਉਹਨੂੰ ਨਿਟਿੰਗ ਡਿਜ਼ਾਈਨ ਮੈਨੂੰ ਬਹੁਤ ਸੋ ਸਰਲ ਲੱਗਦੇ ਆ ਜਿਵੇਂ ਮਰਜ਼ੀ ਬਣਵਾ ਲਓ ਮੈਂ ਓਵੇਂ ਹੀ ਬਣਾ ਲੈਂਦੀ ਹਾਂ ਨਿਟਿੰਗ ਡਿਜ਼ਾਈਨ ਨਾਲ ਤਾਂ ਮੈਨੂੰ ਇੰਨਾ ਵਧੀਆ ਲੱਗਦਾ ਨਿਟਿੰਗ ਦਾ ਤਾਂ ਕੰਮ ਕਰਨਾ ਮੈਨੂੰ ਆਨੰਦ ਆਉਂਦਾ ਖੁਸ਼ੀ ਮਿਲਦੀ ਹੈ ਮੈਂ ਕਿਸੀ ਦੇ ਬਣਾ ਕੇ ਪਾਉਂਦੀ ਹਾਂ ਤਾਂ